ਮੈਂ ਇੱਕ ਟਿਊਸ਼ਨ ਸੈਂਟਰ ਚਲਾਉਂਦੀ ਹਾਂ ਇੱਕ ਵਾਰੀ ਮੇਰੇ ਕੋਲ ਇੱਕ ਕੁੜੀ ਪੜ੍ਹਦੀ ਹੁੰਦੀ ਸੀ ਦਸਵੀਂ ਦੇ ਵਿੱਚ ਉਸ ਨੂੰ ਲੋੜ ਸੀ ਕੰਮ ਦੀ ਅਤੇ ਮੈਂ ਉਹਨੂੰ ਛੋਟੇ ਬੱਚਿਆਂ ਦੇ ਪੜ੍ਹਾਉਣ ਦਾ ਨਾਲ ਕੰਮ ਦੇ ਦਿੱਤਾ ਇੱਕ ਵਾਰੀ ਮੇਰੇ ਕੋਲ ਇੱਕ ਅੰਨਾ ਬੱਚਾ ਆਇਆ ਉਹ ਬੱਚੇ ਨੇ ਉਹਨੂੰ ਜਿਹੜਾ ਜਿਹਾ ਹੱਥ ਲੱਗ ਗਿਆ ਉਹ ਬੱਚੇ ਨੇ ਤਾਂ ਉਹਦੇ ਤੋਂ ਮਾਫੀ ਵੀ ਮੰਗ ਲਈ ਪਰ ਉਹ ਕੁੜੀ ਇੰਨੀ ਜ਼ਿਆਦਾ ਸ ਤੇਜ਼ ਸੀ ਉਹ ਕੁੜੀ ਨੇ ਉਸਨੂੰ ਬਹੁਤ ਬੁਰਾ ਭਲਾ ਕਿਹਾ ਪਰ ਮੈਨੂੰ ਉਹਦੇ ਨਾਲ ਕੰਮ ਕਰਨਾ ਪਿਆ ਕਿਉਂਕਿ ਮੈਨੂੰ ਉਹ ਛੋਟੇ ਬੱਚਿਆਂ ਦੇ ਨਾਲ ਉਹਨਾਂ ਨੂੰ ਪੜ੍ਹਾਉਣਾ ਸੀ ਇਸ ਕਰਕੇ ਮੈਂ ਉਸ ਇਸ ਵਿਅਕਤੀ ਦੇ ਨਾਲ ਕੰਮ ਕਰਨਾ ਪਿਆ ਜਿਹੜਾ ਕਿ ਮੇਰੇ ਲਈ ਮੁਸ਼ਕਿਲ ਸੀ ਪਹਿਲਾਂ ਤਾਂ ਮੈਂ ਉਸ ਕੁੜੀ ਨੂੰ ਪਹਿਲਾਂ ਚੰਗੀ ਤਰ੍ਹਾਂ ਸਮਝਾਇਆ ਕਿ ਦੇਖ ਬੱਚੇ ਜਿਹੜੇ ਅੰਨਾ ਹੁੰਦਾ ਹੈ ਅੰਨਾ ਬੱਚਾ ਹੈ ਉਹ ਜਿਹੜਾ ਦੇਖ ਹੀ ਨਹੀਂ ਸਕਦਾ ਹੈ ਉਹ ਅਗਰ ਤੈਨੂੰ ਜਰਾ ਜਿਹਾ ਉਹਦਾ ਹੱਥ ਲੱਗ ਗਿਆ ਹੈ ਅਤੇ ਫਿਰ ਕੀ ਹੋਇਆ ਉਸ ਨੂੰ ਪਿਆਰ ਦੇ ਨਾਲ ਸਮਝਾ ਕੇ ਫਿਰ ਮੈਂ ਦੂਸਰੇ ਬੱਚਿਆਂ ਦੇ ਨਾਲ ਜਿਹੜਾ ਉਹ ਉਸ ਅੰਨੇ ਵਿਅਕਤੀ ਨੂੰ ਤਾਂ ਮੈਂ ਹੀ ਪੜ੍ਹਾਇਆ ਪਰ ਜਿਹੜਾ ਦੂਸਰੇ ਬੱਚਿਆਂ ਦਾ ਜਿਹੜਾ ਛੋਟੇ ਬੱਚੇ ਦੇ ਨਾਲ ਸੀ ਉਹਨੂੰ ਨਾਲ ਉਸ ਨੂੰ ਬਿਠਾ ਕੇ ਪਰਵਾਣਾ ਪਿਆ ਕਿਉਂਕਿ ਛੋਟੇ ਬੱਚੇ ਜਲਦੀ ਕੰਮ ਕਰਨ ਦੇ ਵਿੱਚ ਨਹੀਂ ਆਉਂਦੇ ਹਨ ਇਸ ਕਰਕੇ ਮੈਂ ਉਸ ਵਿਅਕਤੀ ਦੇ ਨਾਲ ਆਪਣੀ ਟਿਊਸ਼ਨ ਸੈਂਟਰ ਚਲਾਇਆ ਅਤੇ ਉਸ ਵਿਅਕਤੀ ਨੂੰ ਸਮਝਾ ਕੇ ਆਪਣੇ ਨਾਲ ਕੰਮ ਕਰਵਾਉਣ 'ਤੇ ਲਗਾਇਆ ਅੱਜ ਉਹ ਵਿਅਕਤੀ ਮੇਰੇ ਨਾਲ ਕੰਮ ਕਰਦਾ ਹੈ ਪਰ ਉਹ ਬੱਚਿਆਂ ਨ ਨਾਲ ਮੈਨੂੰ ਸਮਝਾਉਣ ਦੇ ਨਾਲ ਇੱਕ ਤਾਂ ਉਸ ਕੁੜੀ ਦੀ ਜ਼ਰੂਰਤ ਪੂਰੀ ਹੋ ਗਈ ਅਤੇ ਮੇਰੀ ਵੀ ਜ਼ਰੂਰਤ ਪੂਰੀ ਹੋ ਗਈ ਕਿ ਉਹ ਮੈਨੂੰ ਛੋਟੇ ਬੱਚੇ ਜਿਹੜੇ ਕਿ ਬਾਰ ਬਾਰ ਬਾਰ ਬਾਰ ਉਹ ਹਰ ਚੀਜ਼ ਨੂੰ ਕੰਮ ਕਰਵਾਉਣ ਲਈ ਕਹਿੰਦੇ ਹਨ ਉਹਨਾਂ ਨੂੰ ਬਾਰ ਬਾਰ ਬੋਲਣਾ ਪੈਂਦਾ ਹੈ ਉਹਨਾਂ ਨੂੰ ਇੱਕ ਪਹਾੜਾ ਵੀ ਯਾਦ ਕਰਵਾਉਣਾ ਹੋਏ ਅਤੇ ਉਹਨਾਂ ਬਾਰ ਬਾਰ ਬੋਲਣਾ ਪੈਂਦਾ ਹੈ ਅਤੇ ਮੈਂ ਇਸ ਦੇ ਨਾਲ ਉਸ ਵਿਅਕਤੀ ਦੇ ਨਾਲ ਕੰਮ ਕੀਤਾ ਅਤੇ ਉਸ ਸਥਿਤੀ ਵਿੱਚ ਸੁਲਝਾਉਣ ਲਈ ਮੈਂ ਇਹ ਕੀਤਾ ਕਿ ਮੈਂ ਉਸਨੂੰ ਸਮਝਾਇਆ ਚੰਗੀ ਤਰ੍ਹਾਂ ਅਤੇ ਉਸਨੂੰ ਛੋਟੇ ਬੱਚੇ ਦੇ ਦਿੱਤੇ ਅਤੇ ਸਾਰੇ ਵੱਡੇ ਬੱਚਿਆਂ ਦੇ ਨਾਲ ਮੈਂ ਕੰਮ ਕਰ ਦਿੱਤਾ ਪਰ ਉਹ ਕੁੜੀ ਦਾ ਨੱਖਰਾ ਹਜੇ ਵੀ ਬਹੁਤ ਹ ਸਾਰੇ ਛੋਟੇ ਛੋਟੇ ਬੱਚੇ ਇਹੀ ਗੱਲ ਕਈ ਵਾਰੀ ਕਹਿੰਦੇ ਹਨ ਕਿ ਮ ਅਧਿਆਪਕ ਜੀ ਮੈਨੂੰ ਇਹ ਬੱਚਾ ਨਾ ਮ ਜਿਹੜੀ ਕੁੜੀ ਆਉਂਦੀ ਹੈ ਕੰਮ ਕਰਦੀ ਹੈ ਉਹ ਮੈਨੂੰ ਬੋਲਦੀ ਹੈ ਅਤੇ ਫਿਰ ਮੈਂ ਉਸ ਕੁੜੀ ਨੂੰ ਪਿਆਰ ਨਾਲ ਸਮਝਾਇਆ ਕਿ ਤੂੰ ਛੋਟੇ ਬੱਚਿਆਂ ਦੇ ਨਾਲ ਕਿਸ ਤਰ੍ਹਾਂ ਕੰਮ ਕਰਨਾ ਹੈ ਕਿਉਂਕਿ ਉਹ ਕੁੜੀ ਨੂੰ ਲੋੜ ਸੀ ਕੰਮ ਦੀ ਅਤੇ ਮੈਨੂੰ ਵੀ ਲੋੜ ਸੀ ਕੰਮ ਦੀ ਮੈਂ ਉਸ ਮੁਸ਼ਕਿਲ ਤੋਂ ਨਿਕਲਣ ਲਈ ਆਪਣੇ ਆਪ ਨੂੰ ਸਮਝਾ ਕੇ ਅਤੇ ਉਸ ਕੁੜੀ ਨੂੰ ਸਮਝਾ ਕੇ ਅਸੀਂ ਇਸ ਤਰ੍ਹਾਂ ਨਾਲ ਆਪਣਾ ਟਿਊਸ਼ਨ ਸੈਂਟਰ ਚਲਾਇਆ